ਪੰਜਾਬ ਵਿੱਚ ਮੀਡੀਆ ਹੋਰ ਮੀਡੀਆ ਸੰਸਥਾਵਾਂ ਜਾਂ ਸਟੇਕ ਹੋਲਡਰਾਂ ਦਾ ਸਮਰਥਨ ਜਾਂ ਸਹਿਯੋਗ ਕਾਫੀ ਕਰਦਾ ਹੈ ਜੇਕਰ ਮੀਡੀਆ ਦਾ ਸਟੇਕ ਹੋਲਡਰ ਕੁਝ ਵੀ ਗਲਤ ਕਰਦਾ ਹੈ ਤਾਂ ਕੱਲ ਨੂੰ ਉਸ ਦੀ ਖਬਰ ਨੂੰ ਦੱਬਿਆ ਜਾ ਸਕਦਾ ਹੈ ਉਸ ਦਾ ਸੱਚ ਲੋਕਾਂ ਸਾਹਮਣੇ ਸਾਹਮਣੇ ਨਹੀਂ ਆ ਸਕਦਾ ਅਤੇ ਜੋ ਹੋਰ ਮੀਡੀਆ ਸੰਸਥਾਨ ਨੇ ਜੇਕਰ ਉਹ ਕੋਈ ਗਲਤੀ ਕਰਦੇ ਹਨ ਜੇਕਰ ਉਹ ਖ ਕੋਈ ਖਬਰ ਨਹੀਂ ਦਿਖਾਉਂਦੇ ਹਨ ਤਾਂ ਉਸ ਦਾ ਵੀ ਮੀਡੀਆ ਸਮਰਥਨ ਕਰਦਾ ਹੈ ਅਤੇ ਮੀਡੀਆ ਇਹ ਗੱਲ ਲੋਕਾਂ ਨੂੰ ਨਹੀਂ ਦੱਸਦਾ ਕਿ ਉਹ ਕੀ ਗਲਤੀ ਕਰ ਰਹੇ ਹਨ ਅਤੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਅਤੇ ਉਹ ਕਿਉਂ ਨਹੀਂ ਇਸ ਗੱਲ ਨੂੰ ਦਿਖਾ ਰਹੇ